ਮੇਰਾ ਨਾਂ ਰਾਘਵ ਹੈ ਮੈਂ ਪਠਾਨਕੋਟ ਸ਼ਹਿਰ ਦਾ ਰਹਿਣ ਵਾਲਾ ਹਾਂ ਮੈਂ ਅਤੇ ਮੇਰਾ ਦੋਸਤ ਅਕਸਰ ਬਾਈਕ 'ਤੇ ਘੁੰਮਦੇ ਰਹਿੰਦੇ ਹਾਂ ਅਸੀਂ ਸਾਨੂੰ ਬਾਈਕਾਂ ਬਹੁਤ ਪਸੰਦ ਹੈ ਅਸੀਂ ਕੁਝ ਕੁ ਦਿਨਾਂ ਪਹਿਲੇ ਵੈਸ਼ਨੋ ਮਾਤਾ ਜਾਣ ਲਈ ਵੀ ਜਾਣ ਲਈ ਤਿਆਰ ਹੋਏ ਸੀ ਅਤੇ ਅੱਜ ਅਸੀਂ ਬਾਈਕ 'ਤੇ ਵੈਸ਼ਨੂੰ ਮਾਤਾ ਜਾ ਰਹੇ ਹਾਂ ਮੈਂ ਅਤੇ ਮੇਰਾ ਦੋਸਤ ਬਾਈਕ 'ਤੇ ਜਾ ਰਹੇ ਹਾਂ ਤਾਂ ਸਾਨੂੰ ਰਸਤੇ 'ਚ ਬੜੀ ਜਗ੍ਹਾ ਅਸੀਂ ਰੁਕੇ ਜਿਸ ਵਿੱਚ ਅਸੀਂ ਖਾ ਖਾਣ ਖਾਧਾ ਪੀਤਾ ਫੋਟੋਆਂ ਵੀ ਖਿੱਚੀਆਂ ਅਤੇ ਕਈ ਮੌਜ ਮਸਤੀ ਕਰਦੇ ਕਰਦੇ ਅਸੀਂ ਵੈਸ਼ਨੋ ਮਾਤਾ ਪਹੁੰਚੇ ਤਾਂ ਉੱਥੇ ਪਹੁੰਚ ਕੇ ਅਸੀਂ ਬਹੁਤ ਮਜੇ ਕਿਤੇ ਅਤੇ ਸਾਡੇ ਅਸੀਂ ਵਾਤਾਵਰਨ ਨੂੰ ਜਾਣਕਾਰੀ ਬਹੁਤ ਜ਼ਿਆਦਾ ਜਾਣਕਾਰੀ ਦਿੱਤੀਆਂ ਸਾਨੂੰ ਉੱਥੇ ਦੇ ਬਾਈਕ 'ਤੇ ਵਾਤਾਵਰਨ ਬਹੁਤ ਵਧੀਆ ਲੱਗਾ ਬਾਈਕ 'ਤੇ ਜਾਂਦੇ ਜਾਂਦੇ ਸਾਨੂੰ ਠੰਡੀ ਹਵਾ ਪੈ ਰਹੀ ਸੀ ਲਾਗੇ ਕਈ ਪਹਾੜ ਲੱਭੇ ਸਾਨੂੰ ਅਤੇ ਵੱਖ ਵੱਖ ਤਰ੍ਹਾਂ ਦੇ ਚਿੱਤਰ ਲੱਭੇ ਅਤੇ ਅਸੀਂ ਦੋਵੇਂ ਮਾਤਾ ਦੇ ਦਰਸ਼ਨ ਕਰਕੇ ਸਲਾਹ ਬਣਾਈ ਕਿ ਅੱਗੇ ਵੀ ਕਿਤੇ ਘੁੰਮ ਆਉਂਦੇ ਹਾਂ ਤਾਂ ਅਸੀਂ ਉੱਧਰੋਂ ਕਸ਼ਮੀਰ ਨੂੰ ਨਿਕਲ ਗਏ ਕਸ਼ਮੀਰ ਬਾਈਕ 'ਤੇ ਕਸ਼ਮੀਰ ਜਾਂਦੇ ਜਾਂਦੇ ਅਸੀਂ ਕਈ ਨਜ਼ਾਰੇ ਦੇਖੇ ਕਈ ਪਹਾੜ ਦੇਖੇ ਸਾਫ ਰੋਡ 'ਤੇ ਚਲਦੇ ਚਲਦੇ ਅਸੀਂ ਕਈ ਮਜ਼ੇ ਕੀਤੇ ਬਾਈਕ ਦਾ ਆਪਣਾ ਹੀ ਮਜ਼ਾ ਆ ਰਿਹਾ ਸੀ ਕਦੇ ਮੈਂ ਚਲਾ ਰਿਹਾ ਸੀ ਅਤੇ ਮੇਰਾ ਦੋਸਤ ਪਿੱਛੇ ਬੈਠ ਕੇ ਵੀਡੀਓ ਬਣਾ ਰਿਹਾ ਸੀ ਅਤੇ ਜਿੱਥੇ ਅਸੀਂ ਥੱਕ ਜਾਂਦੇ ਸੀ ਅਤੇ ਮੈਂ ਮੇਰਾ ਦੋਸਤ ਬਾਈਕ ਚਲਾਉਂਦਾ ਸੀ ਅਤੇ ਮੈਂ ਪਿੱਛੇ ਬਹਿ ਜਾਂਦਾ ਸੀ ਅਸੀਂ ਦੋਨਾਂ ਨੇ ਕਈ ਸਫਰ ਕਈ ਸਫਰ ਕੀਤੇ ਅਤੇ ਨਾਲੇ ਬਹੁਤ ਮਜ਼ੇ ਕੀਤੇ ਮੈਂ ਆਪ ਜੀ ਨੂੰ ਸਲਾਹ ਇਹ ਹੀ ਦਵਾਂਗਾ ਕਿ ਮੈਨੂੰ ਬਾਈਕ 'ਤੇ ਧਰਮ ਇੱਥੇ ਵੈਸ਼ਨੋ ਮਾਤਾ ਜਾ ਕੇ ਯਾਤਰਾ ਬਹੁਤ ਵਧੀਆ ਲੱਗੀ ਮੈਂ ਆਪ ਨੂੰ ਵੀ ਇਹੀ ਸਲਾਹ ਦਵਾਂਗਾ ਕਿ ਜਦੋਂ ਵੀ ਕਿਤੇ ਘੁੰਮਣ ਜਾਓ ਤਾਂ ਬਾਈਕ 'ਤੇ ਹੀ ਜਾਓ ਕਿਉਂਕਿ ਇੱਕ ਤਾਂ ਇਸ 'ਤੇ ਪੈਟਰੋਲ ਦੀ ਬੱਚਤ ਹੁੰਦੀ ਹੈ ਅਤੇ ਤੁਸੀਂ ਆਸ ਪਾਸ ਦੇ ਨਜ਼ਾਰਿਆਂ ਦਾ ਮਜ਼ਾ ਵੀ ਲੈ ਸਕਦੇ ਹੋ